ਸਤਿ ਸ਼੍ਰੀ ਅਕਾਲ ਭਾਅ ਜੀ ਭਗਤ ਜੀ ਫਾਸਟਫੂਡ ਤੋਂ ਬੋਲ ਰਹੇ ਹੋ ਹਾਂਜੀ ਭਾਅ ਜੀ ਕੀ ਹਾਲ ਚਾਲ ਹੈ ਜੀ ਠੀਕ ਹੋ ਜੀ ਹਾਂਜੀ ਭਾਅ ਜੀ ਥੋੜ੍ਹੇ ਚਿਰ ਪਹਿਲਾਂ ਨਾ ਆਪਾਂ ਦਾਲ ਮੱਖਣੀ ਬਟਰ ਨਾਨ ਅਤੇ ਮਿਕਸ ਵੈਜ ਦੀ ਸਬਜ਼ੀਆਂ ਔਡਰ ਕੀਤੀਆਂ ਸੀ ਇਹ ਤੁਸੀਂ ਹੁਣ ਹੋਰ ਐਡਰੈਸ 'ਤੇ ਪੇ ਪਹੁੰਚਦੀਆਂ ਕਰ ਦਿਓ ਜੀ ਅਤੇ ਐਡਰੈਸ ਤੁਹਾਨੂੰ ਆਪਾਂ ਮੈਸੇਜ 'ਚ ਸੈਂਡ ਕਰ ਦਿੰਦੇ ਹਾਂ ਅਤੇ ਜੋ ਵੀ ਤੁਹਾਡੇ ਐਕਸਟਰਾ ਚਾਰਜਿਸ ਹੋਣਗੇ ਉਹ ਆਪਾਂ ਉਸੇ ਟਾਈਮ ਤੁਹਾਨੂੰ ਪੇ ਕਰ ਦਿਆਂਗੇ ਹਾਂਜੀ ਧੰਨਵਾਦ ਜੀ